ਮੌਜੂਦਾ ਕ੍ਰਿਸ਼ੀ ਵਿਗਿਆਪਨ ਅਤੇ ਵਧੇਰੇ ਲੋਕਾਂ ਤੱਕ ਪਹੁੰਚਣ ਦੇ ਤਰੀਕੇ ਹਨ ਇਸ਼ਤਿਆਰਾਂ ਰਾਹੀਂ ਰੈਲੀਆਂ ਰਾਹੀਂ ਫੋਨਾਂ ਮੋਬਾਇਲਾਂ ਰਾਹੀਂ ਜੋ ਸੋਸ਼ਲ ਮੀਡੀਆ ਤੇ ਜੋ ਐਪਸ ਚਲਦੀਆਂ ਹਨ ਫੋਨ ਤੇ ਉਹਨਾਂ ਰਾਹੀਂ ਆਪਾਂ ਲੋਕਾਂ ਤੱਕ ਪਹੁੰਚ ਸਕਦੇ ਹਾਂ ਜੋ ਇਸ਼ਤਿਹਾਰ ਮੇਰੇ ਲਈ ਬਹੁਤ ਰਚਨਾਤਮਕ ਤੇ ਪ੍ਰਭਾਵਸ਼ਾਲੀ ਸੀ ਉਹ ਹੈ ਟੂਰ ਐਂਡ ਟ੍ਰੈਵਲਸ ਜੋ ਕੀ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਹੈ ਇਸ ਲਈ ਮੇਰੇ ਲਈਏ ਬਹੁਤ ਰਚਨਾਤਮਕ ਤੇ ਪ੍ਰਭਾਵਸ਼ਾਲੀ ਹੈ